ਚਿੱਤਰਕਾਰੀ ਸਿਰਫ਼ ਇੱਕ ਹਸਤ ਕਲਾ ਨਹੀਂ ਹੈ ਇਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਹੈ ਆਪਣੇ ਵਿਚਾਰਾਂ ਨੂੰ ਆਪਣੀ ਸੋਚ ਨੂੰ ਇੱਕ ਪੰਨੇ ਦੇ ਉੱਤੇ ਉਤਾਰਨਾ ਚਿੱਤਰਕਾਰੀ ਹੈ ਬਹੁਤ ਲੋਕ ਹਨ ਜੋ ਕਿ ਆਪਣੇ ਵਿਚਾਰ ਪੇਸ਼ ਕਰਦੇ ਹਨ ਬਹੁਤ ਲੋਕ ਆਪਣੀ ਸੋਚ ਪੇਸ਼ ਕਰਦੇ ਹਨ ਅਤੇ ਬਹੁਤ ਲੋਕ ਕੀ ਹੈ ਸਾਹਮਣੇ ਪਈ ਚੀਜ਼ ਨੂੰ ਉਸਨੂੰ ਅੱਛੇ ਤਰੀਕੇ ਨਾਲ ਸਮਝ ਕੇ ਉਸਨੂੰ ਆਪਣੀ ਜੋ ਪੰਨਾ ਹੈ ਉਹਦੇ ਉੱਤੇ ਉਤਾਰਦੇ ਹਨ ਜਾਂ ਹੋਰ ਵੀ ਬਹੁਤ ਮਾਧਿਅਮ ਹਨ ਚਿੱਤਰਕਾਰੀ ਦੇ ਅਤੇ ਪਰ ਹਰ ਮਾਧਿਅਮ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਜੋ ਚੀਜ਼ ਹੈ ਕਿਸੇ ਨੂੰ ਵੀ ਚਿੱਤਰਕਾਰੀ ਦੀ ਬਾਰੇ ਸ਼ੁਰੂਆਤ ਕਰਨ ਦੇ ਲਈ ਇਸ ਕਲਾ ਨੂੰ ਜਾਣਨ ਦੇ ਲਈ ਉਸਨੂੰ ਆਪਣੀ ਸੋਚ ਨੂੰ ਅਤੇ ਜਿਹੜੀ ਉਸਦੀ ਆਪਣੀ ਸਮਝ ਹੈ ਉਹਨੂੰ ਵਧਾਉਣਾ ਬਹੁਤ ਜ਼ਰੂਰੀ ਹੈ ਚ ਕਿ ਆਪਾਂ ਜੇ ਦੇਖਿਆ ਜਾਏ ਪੁਰਾਤਨ ਜ਼ਮਾਨੇ ਦੇ ਵਿੱਚ ਲੋਕਾਂ ਨੇ ਆਪਣੀ ਸੋਚ ਦੇ ਨਾਲ ਸਿਰਫ਼ ਚਿੱਤਕਾਰੀ ਦੇ ਮਦਦ ਦੇ ਨਾਲ ਉਨ੍ਹਾਂ ਨੇ ਲੋਕਾਂ ਦੀ ਸੋਚ ਦੇ ਵਿੱਚ ਬਹੁਤ ਬੜਾ ਕੀ ਹੈ ਜਿਹੜਾ ਸੰਘਰਸ਼ ਹੈ ਉਹ ਲਿਆ ਦਿੱਤਾ ਗਿਆ ਬਹੁਤ ਸਾਰੇ ਚਿੱਤਰਕਾਰ ਹੋਏ ਹਨ ਜੋ ਕਿ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਆਪਣੀ ਸ਼ਮੂਲੀਅਤ ਦਿੱਤੀ ਹੈ ਜਿਨ੍ਹਾਂ ਵਿੱਚ ਰਾਜਾ ਰਵੀ ਵਰਮਾ ਇੱਕ ਚਿੱਤਰਕਾਰ ਹਨ ਜਿਨ੍ਹਾਂ ਦਾ ਨਾਮ ਪੇਸ਼ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਵੀ ਉਹ ਗਰੀਬਾਂ ਦੇ ਮਸੀਹੇ ਸਨ ਹੁਣ ਕਹੋਂਗੇ ਵੀ ਉਹ ਇੱਕ ਚਿੱਤਰਕਾਰ ਗਰੀਬਾਂ ਦਾ ਮਸੀਹਾ ਕਿਸ ਤਰੀਕੇ ਨਾਲ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਚਿੱਤਰ ਦੇ ਨਾਲ ਕਿਉਂਕਿ ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਪਹਿਲਾਂ ਜਿਹੜੀ ਛੋਟੀ ਜਾਤ ਦੇ ਲੋਕ ਹੁੰਦੇ ਸਨ ਜਿਨ੍ਹਾਂ ਨੂੰ ਛੋਟੀ ਜਾਤ ਦੇ ਲੋਕ ਕਿਹਾ ਜਾਂਦਾ ਦਲਿਤ ਉਨ੍ਹਾਂ ਨੂੰ ਮੰਦਰ ਦੇ ਵਿੱਚ ਜਾਣਾ ਵਰਜਿਤ ਸੀ ਨਹੀਂ ਜਾ ਸਕਦੇ ਸਨ ਮੰਦਿਰ ਦੇ ਵਿੱਚ ਤਾਂ ਉਸਦੇ ਉਸ ਲਈ ਉਨ੍ਹਾਂ ਨੂੰ ਕੀ ਕੀਤਾ ਗਿਆ ਜੋ ਰਾਜਾ ਰਵੀ ਵਰਮਾ ਸੀ ਉਨ੍ਹਾਂ ਨੇ ਆਪਣੀ ਸੋਚ ਨਾਲ ਦੇਵੀ ਦੀ ਮੂਰਤੀ ਬਣਾਈ ਵੱਖ ਵੱਖ ਕਹਾਣੀਆਂ ਜੋ ਆਪਾਂ ਮਹਾਂਭਾਰਤ ਦੀ ਇਨ੍ਹਾਂ ਦੀ ਸੁਣਦੇ ਹਾਂ ਉਹ ਉਨ੍ਹਾਂ ਨੇ ਆਪਣੇ ਜੋ ਉਨ੍ਹਾਂ ਦਾ ਚਿੱਤਰ ਦੇ ਨਾਲ ਲੋਕਾਂ ਦੇ ਸਾਹਮਣੇ ਲਿਆਈਆਂ ਤਾਂ ਲੋਕਾਂ ਨੇ ਉਨ੍ਹਾਂ ਦੇ ਚਿੱਤਰਾਂ ਨੂੰ ਪੂਜਣਾ ਸ਼ ਸ਼ੁਰੂ ਕਰ ਦਿੱਤਾ ਉਨ੍ਹਾਂ ਨੇ ਆਪਣੇ ਉਸ ਚਿ ਚਿੱਤਰ ਦੇ ਰਾਹੀਂ ਦੇਵੀ ਦੇ ਦਰਸ਼ਨ ਕਰ ਲਏ ਤਾਂ ਇਸ ਤਰੀਕੇ ਨਾਲ ਜੋ ਸੋਚ ਹੈ ਉਹ ਤੁਹਾਡੇ ਚਿੱਤਰਕਾਰੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀ ਹੈ ਇਹ ਮਾਈਨੇ ਨਹੀਂ ਰੱਖਦਾ ਵੀ ਤੁਸੀਂ ਕਿੰਨਾ ਕ ਸਹੀ ਚਿੱਤਰ ਬਣਾ ਰਹੇ ਹੋ ਮਾਈਨੇ ਰੱਖਦਾ ਹੈ ਕਿ ਤੁਹਾਡਾ ਚਿੱਤਰ ਹੈ ਉਸਦੇ ਵਿੱਚ ਕੋਈ ਸੋਚ ਹੈ ਕਿ ਨਹੀਂ ਤਾਂ ਕੋਈ ਵੀ ਜੋ ਸ਼ੁਰੂਆਤੀ ਚਿੱਤਰਕਾਰ ਹੈ ਜਾਂ ਕੋਈ ਕਲਾ ਦਾ ਪ੍ਰਸ਼ੰਸਕ ਹੈ ਉਸਨੂੰ ਮੈਂ ਇਹੀ ਸਲਾਹ ਦੇਣਾ ਚਾਹਾਂਗਾ ਕਿ ਤੁਸੀਂ ਆਪਣੀ ਕਲਾ ਦੇ ਵਿੱਚ ਸੋਚ ਦੀ ਵਰਤੋਂ ਜ਼ਰੂਰ ਕਰੋ ਸੋਚ ਜ਼ਰੂਰ ਉਸਦੇ ਵਿੱਚ ਡਾਲੋ ਧੰਨਵਾਦ